ਸਾਡੇ ਇਲਾਕੇ ਦਾ ਐੱਮ ਐੱਲ ਏ ਯਾਨੀ ਕਿ ਸਰਪੰਚ ਬਿਕਰਮ ਸਿੰਘ ਮਜੀਠੀਆ ਹੈ ਜੋ ਕਿ ਸੁਭਾਅ ਦੇ ਬਹੁਤ ਹੀ ਵਧੀਆ ਅ ਇਨਸਾਨ ਦਾ ਬੰਦਾ ਹੈ ਜਿਸਨੇ ਕਿ ਲੋਕਾਂ ਦੀਆਂ ਕਈ ਸਮਾਜਿਕ ਅਤੇ ਹੋਰ ਵੀ ਆਰਥਿਕ ਤੌਰ 'ਤੇ ਵੀ ਮਦਦ ਕੀਤੀ ਹੈ ਉਨਾਂ ਨੇ ਇੱਕ ਤਾਂ ਸਾਡੇ ਸਾਰੇ ਇਲਾਕੇ ਦੀਆਂ ਸੜਕਾਂ ਨੂੰ ਜੋ ਕਿ ਕਾਫੀ ਕੱਚੀਆਂ ਸਨ ਟੋਏ ਟਿੱਬੇ ਵਾਲੀਆਂ ਸਨ ਉਹਨਾਂ ਨੂੰ ਵੀ ਠੀਕ ਕਰਵਾਇਆ ਫਿਰ ਉਹਨਾਂ ਨੇ ਗਲੀ ਦੇ ਅ ਗਲੀ ਗਲੀ ਦੇ ਵਿੱਚ ਬਹੁਤ ਬੁਰੀ ਬਦਬੂ ਦਾ ਜੋ ਕਿ ਬਹੁਤ ਹੀ ਜ਼ਿਆਦਾ ਵੱਡਾ ਪ੍ਰਮੁੱਖ ਸਮੱਸਿਆ ਬਣੀ ਹੋਈ ਸੀ ਅਤੇ ਇਲਾਕੇ ਵਿੱਚ ਰਹਿੰਦੇ ਹੋਏ ਲੋਕ ਜਿਹੜੇ ਸੀ ਉਹ ਕਾਫੀ ਬਿਮਾਰ ਹੋ ਰਹੇ ਸਨ ਮੱਛਰਾਂ ਦਾ ਵੀ ਇਲਾਜ ਕੀਤਾ ਉਨਾਂ ਨੇ ਗਲੀ ਦੇ ਵਿੱਚ ਵੱਡੇ ਵੱਡੇ ਟਿਊਬਵੈਲ ਪਵਾਏ ਅਤੇ ਸੀਵਰਜ ਦਾ ਵੀ ਅਸਿਸਟਮ ਸੈੱਟ ਕੀਤਾ ਜਿਸ ਨਾਲ ਕਿ ਹੁਣ ਲੋ ਲੋਕ ਜਿਹੜੇ ਨੇ ਉਹ ਸੁੱਖ ਦਾ ਸਾਹ ਲੈ ਰਹੇ ਹਨ